ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਕਿੱਦਾਂ ਹਾਲ ਜੀ ਭਾਈ ਜਗਦੰਬੇ ਟੂਰ ਐਂਡ ਟਰੈਵਲਰ ਤੋਂ ਬੋਲਦੇ ਭਾਅ ਜੀ ਮੈਂ ਨਾ ਤੁਹਾਡੀ ਕੈਬ ਬੁੱਕ ਕਰਾਈ ਸੀਗੀ ਅਤੇ ਚੰਡੀਗੜ੍ਹ ਜਾਣ ਲਈ ਭਾਅ ਜੀ ਤੁਸੀਂ ਅੱਧਾ ਘੰਟਾ ਕਹਿੰਦੇ ਸੀਗੇ ਪੂਰਾ ਇੱਕ ਘੰਟਾ ਹੋ ਗਿਆ ਮੈਨੂੰ ਇੱਥੇ ਖੜ੍ਹੇ ਨੂੰ ਭਾਅ ਜੀ ਨਾ ਹੀ ਤੁਹਾਡੀ ਟੈਕਸੀ ਆਈ ਨਾ ਹੀ ਤੁਹਾਡੀ ਕੈਬ ਆਈ ਜੀ ਭਾਅ ਜੀ ਮੈਂ ਚੰਡੀਗੜ੍ਹ ਜਾਣਾ ਏ ਜੀ ਉੱਥੇ ਹੋਸਪਿਟਲ ਵਿੱਚ ਦਵਾਈ ਲੈਣ ਅਤੇ ਉੱਥੇ ਟੈਸਟ ਵੀ ਕਰਵਾਉਣੇ ਆ ਉਨਾਂ ਹੀ ਪ੍ਰੋਸੈਸ ਲੇਟ ਹੋਈ ਜਾਂਦਾ ਭਾਅ ਜੀ ਮੇਰਾ ਅਤੇ ਭਾਅ ਜੀ ਮੈਂ ਬਲਾਚੋਰ ਬਾਈਪਾਸ 'ਤੇ ਖੜ੍ਹਾ ਹੋਇਆ ਜੇ ਤੁਸੀਂ ਆਉਣਾ ਵੀ ਹੋਇਆ ਤਾਂ ਬਾਹਰੋਂ ਬਾਹਰ ਆਇਓ ਭਾਅ ਜੀ ਅੰਦਰੋਂ ਟਰੈਫਿਕ ਕੁਝ ਜ਼ਿਆਦਾ ਆ ਠੀਕ ਹੈ ਨਾ ਭਾਅ ਜੀ ਅਤੇ ਮੈਨੂੰ ਇੱਕ ਵਾਰੀ ਦੱਸ ਦਿਉ ਵੀ ਹਾਂ ਵੀ ਕਿੰਨੇ ਟਾਈਮ ਵਿੱਚ ਤੁਸੀਂ ਆਓਂਗੇ ਜਿੱਦਾਂ ਵੀ ਹੈ ਭਾਅ ਜੀ ਭਾਅ ਜੀ ਮੈਂ ਬਹੁਤ ਪਰੇਸ਼ਾਨ ਹੋਇਆ ਪਿਆ ਘੰਟਾ ਹੋ ਗਿਆ ਮੈਨੂੰ ਇੱਥੇ ਖੜ੍ਹੇ ਨੂੰ ਜੀ ਧੰਨਵਾਦ ਭਾਅ ਜੀ